ਮਹਾਂਵਾਰੀ ਔਰਤਾਂ ਨੂੰ ਬਚਪਨ ਤੋਂ ਹੀ ਭਾਵ ਕਿ ਬਾਰ੍ਹਾਂ ਕੁ ਸਾਲ ਦੀ ਉਮਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਜਦੋਂ ਇਹ ਸ਼ੁਰੂ ਹੁੰਦੀ ਹੈ ਤਾਂ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਔਖਿਆਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਸ਼ੁਰੂ ਸ਼ੁਰੂ ਵਿੱਚ ਕਈਆਂ ਨੂੰ ਤਾਂ ਪੇਟ ਦੀਆਂ ਬਹੁਤ ਪ੍ਰੋਬਲਮਾਂ ਆਉਂਦੀਆਂ ਨੇ ਅਤੇ ਦਰਦ ਵੀ ਬਹੁਤ ਹੁੰਦਾ ਹੈ ਅਤੇ ਛੋਟੇ ਬੱਚਿਆਂ ਨੂੰ ਇਹਨਾਂ ਚਾਰ ਦਿਨਾਂ ਦੇ ਵਿੱਚ ਸਾਂਭ ਸੰਭਾਲ ਕਰਨੀ ਵੀ ਔਖੀ ਲੱਗਦੀ ਹੈ ਅਤੇ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਾਫ ਸੁਥਰੇ ਕੱਪੜੇ ਦੀ ਵਰਤੋਂ ਕਰਨ ਜਿੰਨਾਂ ਨੂੰ ਮਹਾਂਵਾਰੀ ਨਾ ਆਵੇ ਤਾਂ ਉਹਨਾਂ ਲਈ ਵੀ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਇਸ ਦੇ ਨਾ ਆਉਣ ਕਰਕੇ ਬੱਚਾ ਨਾ ਹੋਣ ਦੀ ਪ੍ਰੋਬਲਮ ਆਉਂਦੀ ਹੈ ਮਹਾਂਵਾਰੀ ਆਉਣ ਦੇ ਦੌਰਾਨ ਸਾਨੂੰ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਇਹਨਾਂ ਦਿਨਾਂ ਦੇ ਵਿੱਚ ਠੰਡੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਦੋਂ ਕਿ ਗਰਮ ਤਾਸੀਰ ਦੀਆਂ ਚੀਜਾਂ ਹੀ ਖਾਣੀਆਂ ਚਾਹੀਦੀਆਂ ਹਨ ਅਤੇ ਮਹਾਂਵਾਰੀ ਦੇ ਦੌਰਾਨ ਕੱਪੜਾ ਵੀ ਸਾਫ ਸੁਥਰਾ ਵਰਤਣਾ ਚਾਹੀਦਾ ਹੈ ਤਾਂ ਕਿ ਕਿਸੇ ਤਰ੍ਹਾਂ ਦੇ ਕੋਈ ਇਨਫੈਕਸ਼ਨ ਨਾ ਹੋਵੇ ਨਹੀਂ ਤਾਂ ਇਹ ਸਰੀਰ ਦੇ ਲਈ ਹਾਨੀਕਾਰਕ ਹੈ